ਜੀ ਹਾਂ ਮੇਰੇ ਕੋਲ ਪੁਰਾਣੀ ਤਸਵੀਰਾਂ ਦੀਆਂ ਹਾਰਡ ਕੋਪੀਆਂ ਪਈਆਂ ਹੋਈਆਂ ਨੇ ਜੋ ਕਿ ਮੇਰੇ ਨਿੱਕੇ ਹੁੰਦੇ ਦੀਆਂ ਜਨਮਦਿਨ ਦੀਆਂ ਨੇ ਉਹਨਾਂ ਵਿੱਚ ਕਾਫੀ ਜ਼ਿਆਦਾ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਮੈਂ ਅੱਜ ਵੀ ਦੇਖ ਕੇ ਕਾਫੀ ਖੁਸ਼ ਹੋ ਜਾਂਦੀ ਹਾਂ ਅਤੇ ਹੁਣ ਸਮੇਂ ਉਸ ਸਮੇਂ ਨੂੰ ਯਾਦ ਕਰਦੀ ਹਾਂ ਅੱਜ ਦੇ ਡਿਜੀਟਲ ਤਸਵੀਰਾਂ ਵਿੱਚ ਇੱਕੋ ਚੀਜ਼ ਦਾ ਅੰਤਰ ਆਇਆ ਹੈ ਕਿ ਡਿਜੀਟਲ ਤਸਵੀਰਾਂ ਨੂੰ ਦੇਖੀਏ ਤਾਂ ਉਹਨਾਂ ਦੀ ਕਲੈਰਿਟੀ ਬਹੁਤ ਹੀ ਜ਼ਿਆਦਾ ਹੈ ਅਤੇ ਪੁਰਾਣੇ ਤਸਵੀਰਾਂ ਨੂੰ ਥੋੜ੍ਹਾ ਘੱਟ ਕਲੈਰਿਟੀ ਨਾਲ ਦੇਖਿਆ ਜਾ ਸਕਦਾ ਹੈ ਪਰ ਜੇ ਆਪਾਂ ਆਪਣੇ ਭਾਵਨਾਵਾਂ ਦੀਆਂ ਗੱਲਾਂ ਕਰੀਏ ਅਤੇ ਮੇਰਾ ਵਿਚਾਰ ਇਹੀ ਹੈ ਕਿ ਸਾਡੀਆਂ ਭਾਵਨਾਵਾਂ ਪੁਰਾਣੀ ਤਸਵੀਰਾਂ ਨਾਲ ਜ਼ਿਆਦਾ ਜੁੜੀਆਂ ਹੋਈਆਂ ਨੇ ਕਿਉਂਕਿ ਪੁਰਾਣੀ ਤਸਵੀਰਾਂ ਦੀਆਂ ਹਾਰਡ ਕੋਪੀਆਂ ਸਾਨੂੰ ਉਹਨਾਂ ਦੀ ਯਾਦ ਵੀ ਦਵਾਉਂਦੀ ਹੈ ਜਿਹੜੇ ਅੱਜ ਸਾਡੇ ਨਾਲ ਨਹੀਂ ਹੈਗੇ ਨੇ ਉਹਨਾਂ ਨੂੰ ਹਮੇਸ਼ਾ ਸਾਡੇ ਨਾਲ ਰੱਖਣ 'ਤੇ ਮਜਬੂਰ ਕਰਦੀਆਂ ਨੇ ਪਰ ਜੇ ਡਿਜੀਟਲ ਤਸਵੀਰਾਂ ਦੀ ਗੱਲ ਕਰੀਏ ਤਾਂ ਉਹ ਇੰਨੀਆਂ ਕੁ ਖਾਸ ਨਹੀਂ ਹੁੰਦੀਆਂ ਕਿਉਂਕਿ ਉਹ ਕਿਸੇ ਟਾਈਮ ਵੀ ਸਾਡੇ ਤੋਂ ਡਿਲੀਟ ਹੋ ਸਕਦੀਆਂ ਨੇ ਲੇਕਿਨ ਪੁਰਾਣੀ ਤਸਵੀਰਾਂ ਦੀਆਂ ਹਾਰਡ ਕੋਪੀਆਂ ਸਾਡੇ ਨਾਲ ਹਮੇਸ਼ਾ ਰਹਿਣਗੀਆਂ ਅਤੇ ਸਾਨੂੰ ਸਾਡੇ ਨਾਲ ਰਹਿਣ ਵਾਲੇ ਇਨਸਾਨਾਂ ਦੀਆਂ ਯਾਦ ਵੀ ਦਿਲਾਉਣਗੀਆਂ